ਵੈਸੇ ਤਾਂ ਮੈਨੂੰ ਬਹੁਤ ਸਾਰੇ ਪੌਦੇ ਪਸੰਦ ਹਨ ਪਰ ਮੈਂ ਅਮਰੂਦ ਦਾ ਪੌਦਾ ਉਗਾਉਣਾ ਪਸੰਦ ਕਰਾਂਗੀ ਕਿਉਂਕਿ ਉਹ ਬਹੁਤ ਛੇਤੀ ਵੱਧਦਾ ਫੁੱਲਦਾ ਹੈ ਅਤੇ ਉਹ ਬਹੁਤ ਜਲਦੀ ਹੀ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ ਅਤੇ ਫੁੱਲਾਂ ਵਿੱਚ ਮੈਂ ਗੁਲਾਬ ਦਾ ਫੁੱਲ ਅਤੇ ਗੇਂਦੇ ਦਾ ਫੁੱਲ ਉਗਾਉਣਾ ਚਾਹਾਂਗੀ ਕਿਉਂਕਿ ਉਹ ਬਹੁਤ ਹੀ ਵਧੀਆ ਅਤੇ ਬਹੁਤ ਹੀ ਖੁਸ਼ਬੂਦਾਰ ਹੁੰਦੇ ਹਨ ਅਤੇ ਫਲਾਂ ਵਿੱਚ ਮੈਂ ਜਿਵੇਂ ਕਿ ਅ ਅਮਰੂਦ ਉਗਾਉਣਾ ਚਾਹਾਂਗੀ ਅਤੇ ਸਬਜ਼ੀਆਂ ਵਿੱਚ ਜਿਵੇਂ ਆਪਾਂ ਘਰੇ ਘੀਆ ਲਗਾ ਸਕਦੇ ਹਾਂ ਅਤੇ ਮਟਰ ਲਗਾ ਸਕਦੇ ਹਾਂ ਹਰੀ ਮਿਰਚ ਲਗਾ ਸਕਦੇ ਹਾਂ ਅਤੇ ਐਵੇਂ ਦੀਆਂ ਬਹੁਤ ਸਾਰੀਆਂ ਸਬਜ਼ੀਆਂ ਲਗਾ ਸਕਦੇ ਹਾਂ ਅਤੇ ਉਹਨਾਂ ਦਾ ਇੱਕ ਇਹ ਫਾਇਦਾ ਹੈ ਕਿ ਜੇ ਆਪਾਂ ਆਪਣੇ ਘਰ ਉਗਾਉਦੇ ਹਾਂ ਤਾਂ ਉਹ ਆਪਾਂ ਨੂੰ ਇੱਕ ਫਰੈਸ਼ ਚੀਜ਼ ਮਿਲਦੀ ਹੈ ਅਤੇ ਬਾਹਰ ਦੀ ਖਰੀਦੀ ਹੋਈ ਚੀਜ਼ ਦਾ ਆਪਾਂ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਹ ਕਿੰਨੇ ਦਿਨ ਪਹਿਲਾ ਦੀ ਹੈ ਅਤੇ ਕਿੰਨੇ ਕਿੰਨੀ ਪੁਰਾਣੀ ਹੈ